ਭਾਰਤ ਦੇ ਅਲੱਗ ਅਲੱਗ ਰਾਜਾਂ ਵਿੱਚ ਅਲੱਗ ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਕੁੱਲ ਭਾਰਤ ਵਿੱਚ ਬਾਈ ਭਾਸ਼ਾਵਾਂ ਨੂੰ ਸਰਕਾਰੀ ਭਾਸ਼ਾ ਹੋਣ ਦਾ ਦਰਜਾ ਪ੍ਰਾਪਤ ਹੈ ਇਸ ਵਿੱਚ ਅਸਾਮੀ ਬੰਗਾਲੀ ਗੁਜਰਾਤੀ ਹਿੰਦੀ ਕੰਨੜ ਕਸ਼ਮੀਰੀ ਮਲਿਆਲਮ ਮਨੀਪੁਰੀ ਮਰਾਠੀ ਨੇਪਾਲੀ ਉੜੀਆ ਪੰਜਾਬੀ ਸੰਸਕ੍ਰਿਤ ਸਿੰਧੀ ਤਮਿਲ ਤੇਲਗੂ ਉਰਦੂ ਬੋਧੋ ਸੰਨਥਲੀ ਮੈਥੇਲੀ ਡੋਗਰੀ ਆਦਿ ਭਾਸ਼ਾਵਾਂ ਹਨ ਹਿੰਦੀ ਦੇਸ਼ ਦੀ ਸਰਕਾਰੀ ਭਾਸ਼ਾ ਵਜੋਂ ਸਭ ਤੋਂ ਜ਼ਿਆਦਾ ਪ੍ਰਚੱਲਿਤ ਹੈ ਅਤੇ ਪੰਜਾਬ ਵਿੱਚ ਮਾਝੀ ਮਲਵਈ ਪੁਆਧੀ ਆਦਿ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ